ਕਿਸਾਨ ਕਰਜ਼ੇ ਤੋਂ ਤੰਗ ਆ ਕੇ ਵੀ ਖੁਦਕੁਸ਼ੀਆਂ ਕਰਦਾ ਆੜ੍ਹਤੀਆਂ ਤੋਂ ਤੰਗ ਆ ਕੇ ਵੀ ਖੁਦਕੁਸ਼ੀਆਂ ਕਰਦਾ ਸਰਕਾਰਾਂ ਤੋਂ ਤੰਗ ਆ ਕੇ ਵੀ ਖੁਦਕੁਸ਼ੀਆਂ ਕਰ ਖੁਦਕੁਸ਼ੀਆਂ ਕਰਦਾ ਸਰਕਾਰਾਂ ਨੂੰ ਇਹਨਾਂ ਦੀ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਨੂੰ ਇਹਨਾਂ ਦੇ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ ਇਹਨਾਂ ਨੂੰ ਘੱਟ ਤੋਂ ਘੱਟ ਵਿਆਜ਼ 'ਤੇ ਪੈਸਾ ਦੇਣਾ ਚਾਹੀਦਾ ਹੈ ਜਿਸ ਕਰਕੇ ਇਹ ਖੁਦਕੁਸ਼ੀਆਂ ਨਾ ਕਰਨ ਔਰ ਆਪਣੇ ਜੀਵਨ ਨੂੰ ਸਫਲ ਬਣਾ ਸਕਣ ਔਰ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ